ਪੁਰਾਤਨ ਸਮੇਂ ਨਾਲੋਂ ਖੇਤੀਬਾੜੀ ਦੇ ਉਦਯੋਗਾਂ ਵਿੱਚ ਪੇਂਡੂ ਭਾਈਚਾਰਿਆਂ ਵਿੱਚ ਸਮੇਂ ਦੀ ਤਬਦੀਲੀ ਨਾਲ ਬਹੁਤ ਹੀ ਵਧੀਆ ਬਦਾ ਬਦਲਾਅ ਆ ਰਿਹਾ ਅਤੇ ਇਹਨਾਂ ਦੇ ਵਿੱਚ ਬਹੁਤ ਸੁਧਾਰ ਕੀਤੇ ਗਏ ਹਨ ਪਰ ਅੱਜ ਵੀ ਜੋ ਮਸ਼ੀਨਾਂ ਨੇ ਉਹ ਬਹੁਤ ਹੀ ਮਹਿੰਗੀਆਂ ਹਨ ਜੋ ਕਿ ਹਰ ਇੱਕ ਕਿਸਾਨ ਨਹੀਂ ਖਰੀਦ ਸਕਦਾ ਅਤੇ ਉਹਨਾਂ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਹੀ ਪ੍ਰਾ ਰੇਟ 'ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਹਰ ਇਨ ਇਨਸਾਨ ਖਰੀਦ ਸਕੇ ਅਤੇ ਉਸਨੂੰ ਮਤਲਬ ਉਸਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਅਤੇ ਪਹਿਲਾਂ ਜਿਵੇਂ ਔਰਗੈਨਿਕ ਖਾਦਾਂ ਵਰਤੀਆਂ ਜਾਂਦੀਆਂ ਸਨ ਅੱਜ ਕੱਲ੍ਹ ਵੀ ਉਵੇਂ ਹੀ ਵਰਤਣਾ ਚਾਹੀਦਾ ਹੈ ਅਤੇ ਬਹੁਤ ਹੀ ਜ਼ਿਆਦਾ ਫਰਟੀਲਾਈਜ਼ਰ ਜਾਂ ਪੈਸਟੀਸਾਈਡਸ ਨਹੀਂ ਵਰਤਣੇ ਚਾਹੀਦੇ ਜੋ ਕਿ ਆਪਣੀ ਧਰਤੀ ਨੂੰ ਅਣਉਪਜਾਊ ਬਨ ਬਣਾਉਂਦੇ ਹਨ ਅਤੇ ਅਤੇ ਸਾਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਸਬਸਿਡੀਆਂ ਦੇਣ ਜਿਹਨਾਂ ਕਰਕੇ ਉਹਨਾਂ ਨੂੰ ਪੈਸੇ ਦੇ ਵਿੱਚ ਜਾਂ ਸੰਦਾ ਨੂੰ ਖਰੀਦਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ